ਸਤਿ ਸ਼੍ਰੀ ਅਕਾਲ ਜੀ ਮੈਂ ਨਵਾਂ ਸ਼ਹਿਰ ਤੋਂ ਬੰਗਾ ਜਾਣਾ ਹੈ ਇਸ ਲਈ ਮੈਂ ਕੈਬ ਬੁੱਕ ਕਰਨੀ ਹੈ ਜੇ ਕੈਬ ਤੋਂ ਬਿਨਾਂ ਵੀ ਤੁਸੀਂ ਮੈਨੂੰ ਕੋਈ ਹੋਰ ਵਾਹਣ ਜਲਦੀ ਉਪਲਬਧ ਕਰਾ ਸਕਦੇ ਹੋ ਤੁਹਾਨੂੰ ਮੇਰੇ ਕੋਲ ਪੁੱਜਣ ਨੂੰ ਕਿੰਨਾ ਸਮਾਂ ਲੱਗੇਗਾ ਤੁਸੀਂ ਇਸ ਬੁਕਿੰਗ ਦੇ ਕਿੰਨੇ ਪੈਸੇ ਲਵੋਗੇ ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਔਨਲਾਈਨ ਪੇਮੈਂਟ ਲੈ ਸਕਦੇ ਹੋ ਜਾਂ ਤੁਹਾਨੂੰ ਨਕਦ ਪੈਸੇ ਹੀ ਚਾਹੀਦੇ ਹਨ ਅਤੇ ਤੁਸੀਂ ਜਿੰਨਾਂ ਛੇਤੀ ਤੋਂ ਛੇਤੀ ਹੋ ਸਕੇ ਆਉਣ ਦੀ ਖੇਚਲ ਕਰਨਾ